ਬਾਈਕਿੰਗ ਦੁਆਰਾ ਸਥਾਨਕ ਅਰਥ ਵਿਵਸਥਾ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ ਇਸ ਲਈ ਸਥਾਨਕ ਸਰਕਾਰ ਨੂੰ ਠੋਸ ਕਦਮ ਚੁੱਕਣੇ ਪੈਣਗੇ ਸਥਾਨਕ ਸਰਕਾਰ ਇਹੋ ਜਿਹੇ ਲੋਕਾਂ ਨਾਲ ਗੱਲਬਾਤ ਕਰੇ ਜਿਹੜੇ ਬਾਈਕਿੰਗ ਨੂੰ ਅੱਗੇ ਬੜਾਵਾ ਦੇ ਸਕਦੇ ਹਨ ਕਿਉਂਕਿ ਬਾਈਕਿੰਗ ਦੁਆਰਾ ਸੈਲਾਨੀਆਂ ਨੂੰ ਸੈਰ ਸਪਾਟੇ ਦੀਆਂ ਇਹੋ ਜਿਹੀਆਂ ਜਗ੍ਹਾਵਾਂ ਉੱਤੇ ਲੈ ਕੇ ਜਾਇਆ ਸਕਦਾ ਹੈ ਜਿਹੜੀਆਂ ਥਾਵਾਂ ਗੱਡੀਆਂ ਉੱਤੇ ਘੁੰਮਣ ਲਈ ਨਹੀਂ ਹੋ ਸਕਦੀਆਂ ਇਸ ਨਾਲ ਵਾਤਾਵਰਣ ਵੀ ਸਵੱਛ ਰਹੇਗਾ ਬਾਈਕਿੰਗ ਕਿਰਾਏ ਉੱਤੇ ਦੇਣ ਨਾਲ ਉਹਨਾਂ ਲੋਕਾਂ ਲਈ ਚੰਗੀ ਆਮਦਨ ਵੀ ਹੋਵੇਗੀ ਜਿਹੜੀ ਸਰਕਾਰ ਨੂੰ ਟੈਕਸ ਦੇ ਜ਼ਰੀਏ ਰੂਪ ਵਿੱਚ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਦੇਵੇਗੀ ਸਰਕਾਰੀ ਨਿਯਮਾਂ ਦੀ ਉਲੰਘਣਾ ਵੀ ਨਹੀਂ ਹੋਵੇਗੀ ਸੈਲਾਨੀਆਂ ਦੀ ਸਿਹਤ ਵੀ ਚੰਗੀ ਰਹੇਗੀ ਅਤੇ ਸੈਲਾਨੀ ਜਿੱਥੇ ਰਹਿੰਦੇ ਹਨ ਉਹਨਾਂ ਹੋਟਲਾਂ 'ਚ ਵੀ ਚੰਗੀ ਆਮਦਨ ਹੋਵੇਗੀ ਉਹ ਹੋਟਲ ਸੈਲਾਨੀਆਂ ਵਾਸਤੇ ਕੁਝ ਨਵੀਆਂ ਸਕੀਮਾਂ ਵੀ ਰੱਖ ਸਕਦੇ ਹਨ ਜਿਹੜੇ ਬਾਈਕਿੰਗ ਨੂੰ ਸੈਰ ਸਪਾਟੇ ਵਾਸਤੇ ਚੁਣਦੇ ਹਨ